ਮੀਡੀਆ ਦਾ ਜਿਹੜਾ ਕੰਮ ਹੈ ਉਹ ਇਹ ਹੈ ਕਿ ਜੋ ਸਾਡੇ ਆਲੇ ਦੁਆਲੇ ਵਿੱਚ ਵਾਪਰ ਰਿਹਾ ਹੈ ਭਾਵੇਂ ਉਹ ਰਾਜਨੀਤਿਕ ਹੋਵੇ ਭਾਵੇਂ ਉਹ ਸਮਾਜਿਕ ਹੋਵੇ ਭਾਵੇਂ ਉਹ ਕਿਸੇ ਵੀ ਆਰਥਿਕ ਪੱਖੋਂ ਹੋਵੇ ਕੁਛ ਵੀ ਹੋਵੇ ਉਹਦਾ ਜਿਹੜਾ ਹੈ ਸੱਚ ਜੋ ਹੈ ਉਹ ਸਾਡੇ ਸਾਹਮਣੇ ਲਿਆਉਣਾ ਹੁੰਦਾ ਹੈ ਪਰ ਅੱਜ ਕੱਲ੍ਹ ਤਾਂ ਜਿਹੜਾ ਮੀਡੀਆ ਹੈ ਉਹ ਸਾਡੇ ਮਤਲਬ ਇਸ ਜੋ ਸਾਡੇ ਆਲੇ ਦੁਆਲੇ ਵਾਪਰਦਾ ਹੈ ਕਈ ਵਾਰ ਕਈ ਖਬਰਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਟੀ ਆਰ ਪੀ ਦੇ ਪਿੱਛੇ ਲੱਗ ਕੇ ਜਿਹੜੇ ਆ ਅੱਜ ਕੱਲ੍ਹ ਦੇ ਜਿਹੜੇ ਚੈਨਲ ਹੈ ਉਹ ਮਤਲਬ ਸ ਜੋ ਸੱਚਾਈ ਹੈ ਉਸ ਨੂੰ ਉਹ ਅੱਖੋ ਪਰੋਖੇ ਕਰ ਦਿੰਦੇ ਆ ਅਤੇ ਸਾਰਾ ਹੀ ਜਿਹੜਾ ਹੈ ਖਬਰ ਜਿਹੜੀ ਹੈ ਜਾਂ ਜਿਹੜੀ ਨਿਊਜ਼ ਹੈਗੀ ਉਹ ਉਸਨੂੰ ਲੋਕਾਂ ਨੂੰ ਬਿਲਕੁਲ ਹੀ ਗਲਤ ਤਰੀਕੇ ਦੇ ਨਾਲ ਪੇਸ਼ ਕਰਦੇ ਹੈ ਔਰ ਜੋ ਸੱਚ ਹੈ ਉਹ ਪਿੱਛੇ ਲੁਕਿਆ ਰਹਿੰਦਾ ਅਤੇ ਜੋ ਉਹ ਦਿਖਾਉਣਾ ਚਾਹੁੰਦੇ ਨੇ ਲੋਕਾਂ ਨੂੰ ਉਹ ਹੀ ਦਿਖਾਇਆ ਜਾਂਦਾ ਅਤੇ ਲੋਕ ਜਿਹੜੇ ਉਹਨਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰ ਲੈਂਦੇ ਆ ਦੂਸਰਾ ਇਹ ਹੈ ਕਿ ਖਬਰਾਂ ਜਿਹੜੀਆਂ ਏ ਉਹ ਮਤਲਬ ਸਹੀ ਨਹੀਂ ਦਿਖਾਉਂਦੇ ਏ ਅਤੇ ਸਾਨੂੰ ਜਿਹੜਾ ਏ ਉਹ ਮਤਲਬ ਝਾਂਸੇ ਦੇ ਵਿੱਚ ਲਿਆ ਕੇ ਬਸ ਸਾਨੂੰ ਜਿਹੜਾ ਹੈ ਉਹ ਆਪਣੇ ਮਗਰ ਲਗਾਉਣਾ ਚਾਹੁੰਦੇ ਏ ਇੱਕ ਹੈ ਕਿ ਮੈਂ ਅੱਜ ਕੱਲ੍ਹ ਜਿਹੜੇ ਹੈ ਮ ਮਸ਼ਹੂਰ ਜਿਹੜੇ ਅਖਬਾਰਾਂ ਨੇ ਮੈਂ ਮਤਲਬ ਪੰਜਾਬੀ ਟ੍ਰਿਬਿਊਨ ਹੈ ਅਜੀਤ ਅਖਬਾਰ ਹੈ ਉਹਦਾ ਹਿੰਦੀ ਸੈਕਸ਼ਨ ਹੈ ਫਿਰ ਦੈਨਿਕ ਭਾਸਕਰ ਹੈ ਅਤੇ ਇਹੋ ਜਿਹੇ ਅਖਬਾਰਾਂ ਨੇ ਔਰ ਇਹ ਅਖਬਾਰਾਂ ਦੇ ਵਿੱਚ ਕੁਛ ਇੱਕ ਮਤਲਬ ਜਿਹੜੇ ਆਰਟੀਕਲ ਹੈ ਮਤਲਬ ਐਡੀਟਰ ਵਾਲਾ ਪੇਜ ਜਿਹੜਾ ਹੁੰਦਾ ਹੈ ਅਜੀਤ ਅਖਬਾਰ ਦੇ ਵਿੱਚ ਜਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹ ਬਹੁਤ ਵਧੀਆ ਹੁੰਦਾ ਏ ਅਤੇ ਇਸ ਦੇ ਨਾਲ ਹੀ ਜਿਹੜੇ ਜਿਸ ਤਰ੍ਹਾਂ ਹਿੰਦੀ ਚੈਨਲ ਹੈਗੇ ਹੈ ਐੱਨ ਡੀ ਟੀ ਵੀ ਹੈ ਏ ਵੀ ਪੀ ਨਿਊਜ਼ ਏ ਆਜ ਤੱਕ ਹੈ ਅਤੇ ਪੰਜਾਬੀ ਚੈਨਲ ਜਿਹੜੇ ਨੇ ਪੰਜਾਬ ਪੀ ਟੀ ਸੀ ਨਿਊਜ਼ ਹੈ ਜ਼ੀ ਨਿਊਜ਼ ਹੈ ਮਤਲਬ ਇਹ ਇਹੋ ਜਿਹੇ ਬਹੁਤ ਸਾਰੇ ਜਿਹੜੇ ਚੈਨਲ ਆ ਉਹ ਚੱਲ ਰਹੇ ਹੈ